ਖੇਡਾਂ ਨਾਲ ਸਰੀਰਕ ਅਤੇ ਮਾਨਸਿਕ ਦੋਨੋਂ ਤਰ੍ਹਾਂ ਦਾ ਵਿਕਾਸ ਹੁੰਦਾ ਹੈ ਜਿਵੇਂ ਕਿ ਰੱਸਾਕਸ਼ੀ ਦੌੜ ਲੁੱਕਣ ਛਿਪੀ ਸਰੀਰਕ ਖੇਡਾਂ ਨੇ ਜਿਵੇਂ ਮਾਨਸਿਕ ਸ਼ਤਰੰਜ ਹੋ ਗਿਆ ਚੈੱਸ ਹੋ ਗਿਆ ਇਸ ਤਰ੍ਹਾਂ ਦੀਆਂ ਖੇਡਾਂ ਨਾਲ ਸਾਡਾ ਮਾਨਸਿਕ ਵਿਕਾਸ ਅਤੇ ਹਰ ਤਰੀਕੇ ਵਿਕਾਸ ਹੁੰਦਾ ਹੈ